ਆਹ ਥੋੜ੍ਹੇ ਦਿਨ ਪਹਿਲਾਂ ਮੈਂ ਪਹਾੜਾਂ ਵਿੱਚ ਘੁੰਮਣ ਗਈ ਸੀ ਜਿੱਥੇ ਮੈਂ ਇੱਕ ਤਸਵੀਰ ਖਿੱਚੀ ਤਸਵੀਰ ਤਾਂ ਮੈਂ ਪਹਾੜ ਦੇ ਵਿੱਚ ਵਹਿੰਦੇ ਝਰਨੇ ਦੀ ਖਿੱਚਣੀ ਚਾਹੀ ਸੀ ਪਰ ਉਹ ਇੱਕ ਜਦੋਂ ਖਿੱਚੀ ਅਤੇ ਉਸ ਤੋਂ ਬਾਅਦ ਜਦੋਂ ਉਹਨੂੰ ਮੈਂ ਦੇਖਿਆ ਤਾਂ ਉਹ ਇੱਕ ਸੀਨਰੀ ਦੇ ਰੂਪ ਵਿੱਚ ਮੈਨੂੰ ਦਿਖੀ ਉਸ ਸੀਨਰੀ ਉਸ ਤਸਵੀਰ ਦੇ ਵਿੱਚ ਇੱਕ ਪਹਾੜ ਇੱਕ ਝਰਨਾ ਬਹੁਤ ਸਾਰੇ ਪੰਛੀ ਜਿਵੇਂ ਕਿ ਮੋਰ ਚਿੜੀਆਂ ਤੋਤਾ ਅਤੇ ਇੱਕ ਬਹੁਤ ਹੀ ਸੋਹਣਾ ਦ੍ਰਿਸ਼ ਮੇਰੇ ਸਾਹਮਣੇ ਆਇਆ ਉਹ ਤਸਵੀਰ ਇੰਨੀ ਕੁ ਖੂਬਸੂਰਤ ਅਤੇ ਇੰਨੀ ਕੁ ਚੰਗੀ ਅਤੇ ਮਨ ਨੂੰ ਸ਼ਾਂਤੀ ਦੇਣ ਵਾਲੀ ਸੀ ਕਿ ਮੈਂ ਉਸਨੂੰ ਦੇਖਦੀ ਰਹਿ ਗਈ ਉਹ ਤਸਵੀਰ ਜਿਹੜੀ ਖਿੱਚੀ ਸੀ ਉਹ ਝਰਨੇ ਦੀ ਸੀ ਪਰ ਬਾਅਦ ਵਿੱਚ ਉਹ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਬਹੁਤ ਜ਼ਿਆਦਾ ਵਧੀਆ ਤਸਵੀਰ ਹੈ ਜਿਸ ਵਿੱਚ ਪੰਛੀ ਵੀ ਅਤੇ ਮੋਰ ਸਪੈ ਮੋਰ ਜ਼ਿਆਦਾਤਰ ਕਿਉਂਕਿ ਮੋਰ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ ਉਹ ਉਹਦੀ ਤਸਵੀਰ ਵੀ ਸੀ ਇਹ ਬਹੁਤ ਹੀ ਚੰਗੀ ਤਸਵੀਰ ਲੱਗੀ ਅਤੇ ਮੈਂ ਹੁਣ ਬਹੁਤ ਸੋਚਦੀ ਹਾਂ ਕਿ ਮੈਂ ਐਵੇਂ ਜਿਹੀ ਤਸਵੀਰਾਂ ਅੱਗੇ ਵੀ ਖਿੱਚਾਂ ਅਤੇ ਉਹ ਵਾਪਸ ਉਸ ਪਲ ਨੂੰ ਮਹਿਸੂਸ ਕਰਾਂ ਜਦੋਂ ਹੀ ਮੈਂ ਉਸ ਤਸਵੀਰ ਨੂੰ ਵੇਖਦੀ ਹਾਂ ਮੈਨੂੰ ਵਾਪਸ ਉਹ ਸਭ ਚੀਜ਼ਾਂ ਯਾਦ ਆ ਜਾਂਦੀਆਂ ਜਦੋਂ ਉਹ ਚੀਜ਼ਾਂ ਵਾਪਸ ਯਾਦ ਆ ਜਾਂਦੀਆਂ ਤਾਂ ਮੈਂ ਉਹ ਝਰਨੇ ਦੀ ਆਵਾਜ਼ ਪੰਛੀਆਂ ਦੀ ਚਹਿ ਚਹਾਹਟ ਅਤੇ ਸਭ ਚੀਜ਼ ਵਧੀਆ ਤਰੀਕੇ ਮਹਿਸੂਸ ਕਰਦੀ ਹਾਂ ਇਹ ਮੈਨੂੰ ਬਹੁਤ ਹੀ ਸਕੂਨ ਅਤੇ ਆਨੰਦ ਦਿੰਦੀ ਹੈ ਅਤੇ ਜਦੋਂ ਮੈਂ ਵਾਪਸ ਤੋਂ ਓ ਇਹ ਚੀ ਇਹ ਚੀਜ਼ਾਂ ਵੇਖਦੀ ਹਾਂ ਤਾਂ ਮੈਨੂੰ ਫਿਰ ਉਸ ਚੀਜ਼ ਨੂੰ ਮਹਿਸੂਸ ਕਰਕੇ ਬਹੁਤ ਹੀ ਚੰਗਾ ਅਤੇ ਵਧੀਆ ਲੱਗਦਾ ਹੈ ਹੁਣ ਜਿਵੇਂ ਕਿ ਆਹ ਪਾ ਪੰਛੀ ਦੀ ਗੱਲ ਹੋ ਗਈ ਜਾਂ ਝਰਨੇ ਦੀ ਗੱਲ ਹੋ ਗਈ ਇਹ ਬਹੁਤ ਹੀ ਵਧੀਆ ਚੀਜ਼ਾਂ ਨੇਚਰ ਜਾਂ ਪ੍ਰਕ੍ਰਿਤੀ ਨੂੰ ਮਹਿਸੂਸ ਕਰਨ ਵਾਲੀ ਚੀਜ਼ਾਂ ਹੈ ਜੋ ਕਿ ਬਹੁਤ ਹੀ ਖੂਬਸੂਰਤ ਹੈ ਪ੍ਰਕਿਰਤੀ ਆਪਣੇ ਵਾਸਤੇ ਬਹੁਤ ਹੀ ਵਧੀਆ ਹੈ ਪ੍ਰਕਿਰਤੀ ਆਪਾਂ ਨੂੰ ਪ੍ਰਕਿਰਤੀ ਦਾ ਧਿਆਨ ਵੀ ਰੱਖਣਾ ਚਾਹੀਦਾ ਫਿਰ ਆਪਣੇ ਪ੍ਰਕਿਰਤੀ ਦੇ ਇਹ ਜੋ ਦ੍ਰਿਸ਼ ਨੂੰ ਸੰਭਾਲਣ ਰੈ ਰੱਖਣ ਵਾਸਤੇ ਸੰਭਾਲਣ ਕਰਨ ਵਾਸਤੇ ਆਪਾਂ ਨੂੰ ਪੋਲਿਊਸ਼ਨ ਜਾਂ ਪ੍ਰਦੂਸ਼ਣ ਤੋਂ ਘਟਾਉਣਾ ਚਾਹੀਦਾ ਪ੍ਰਦੂਸ਼ਣ ਘਟੇਗਾ ਤਾਂ ਹੀ ਆਪਾਂ ਇਹੋ ਜਿਹੀ ਪ੍ਰਕਿਰਤੀ ਦੇ ਦ੍ਰਿਸ਼ ਵ ਜ਼ਿਆਦਾ ਤੋਂ ਜ਼ਿਆਦਾ ਦੇਖ ਸਕਦੇ ਹਾਂ